ਹੈਲੋ ਹਾਂਜੀ ਅੱਛਾ ਆਪਣੀ ਗਲੀ ਦੇ ਵਿੱਚ ਅੱਛਾ ਅੱਛਾ ਹਾਂ ਠੀਕ ਹੈ ਸਾਨੂੰ ਮਿਲੇ ਸੀਗੇ ਠੀਕ ਹੈ ਆਪਾਂ

ਅੱਛਾ ਅਤੇ ਇੱਥੇ ਮੁਕਤਸਰ ਇੱਕ ਤਾਂ ਮੁਕਤੇ ਮਨਾਰ ਪਾਰਕ ਬਣਿਆ ਹੋਇਆ ਬਹੁਤ ਸੋਹਣਾ ਚਾਲੀ ਮੁਕਤਿਆਂ ਦੇ ਅਤੇ ਝੂਲੇ ਝਾਲੇ ਲੱਗੇ ਆ ਸੋਹਣਾ ਪਾਰਕ ਬਣਿਆ ਹੋਇਆ ਵੇਖਣ ਯੋਗ ਆ ਉਹ ਵੀ ਦੂਸਰਾ ਇੱਥੇ ਵੀ ਗੁਰਦੁਆਰੇ ਹੈਗੇ ਇਤਿਹਾਸਕ ਇਹ ਪੈ ਜਾਂਦਾ ਇੱਧਰ ਬਠਿੰਡਾ ਰੋਡ 'ਤੇ ਅਤੇ ਇਸ ਤੋਂ ਇਲਾਵਾ ਵੀ ਗੁਰਦੁਆਰਾ ਹੈਗੇ ਆ ਇਤਿਹਾਸਿਕ ਦਸ ਦਸਵੇਂ ਪਾਤਸ਼ਾਹੀ ਚਰਨ ਸ਼ੋ ਪ੍ਰਾਪਤ ਕੇ ਇੱਥੇ ਯੁੱਧ ਹੋਇਆ ਸੀ ਦਸਵੇਂ ਪਾਤਸ਼ਾਹ ਨੇ ਯੁੱਧ ਕੀਤਾ ਸੀਗਾ ਅਤੇ ਭਾਈ ਮਹਾ ਸਿੰਘ ਦੀ ਟੁੱਟੀ ਗੰਢੀ ਸੀਗੀ ਅਤੇ ਬੇਦਾਅਵਾ ਪਾੜਿਆ ਸੀਗਾ ਜਿਹੜਾ ਸਿੰਘ ਲਿਖ ਕੇ ਦੇ ਆਏ ਸੀਗੇ ਚਾਲੀ ਸਿੰਘਾਂ ਦਾ ਉਹ ਸ਼ਹੀਦ ਹੋਏ ਸੀਗੇ ਅਤੇ ਉਹ ਮਤਲਬ ਕਿ ਉਹ ਗੁਰਦੁਆਰਾ ਉਹਦੇ ਸਾਹਮਣੇ ਹੀ ਇੱਕ ਗਲੀ ਪਾਰ ਕਰਕੇ ਨਾਲ ਹੀ ਸ਼ਹੀਦ ਗੰਜ ਆ ਸ਼ਹੀਦਾਂ ਜਿੱਥੇ ਚਾਲੀ ਸਿੰਘਾਂ ਦਾ ਸੰਸਕਾਰ ਕੀਤਾ ਸੀ ਫਿਰ ਉਸ ਤੋਂ ਬਾਅਦ ਇੱਧਰ ਟਿੱਬੀ ਸਾਹਿਬ ਗੁਰਦੁਆਰਾ ਆ ਆ ਜਾਂਦਾ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਤੀਰ ਜਦੋਂ ਤੀਰ ਮਾਰੇ ਸੀਗੇ ਅਤੇ ਸਿੰਘ ਜਿਹੜੇ ਚਾਲੀ ਸਿੰਘ ਸੀ ਜਿਹੜੇ ਮ ਮੁਗਲਾਂ ਦੇ ਨਾਲ ਲੜਾਈ ਕਰ ਰਹੇ ਸੀਗੇ ਅਤੇ ਗੁਰੂ ਸਾਹਿਬ ਟਿੱਬੀ 'ਤੇ ਬੈਠ ਕੇ ਤੀਰ ਮਾਰਦੇ ਰਹੇ ਤੀਰਾਂ ਉੱਥੇ ਮਤਲਬ ਦੇਖਦੇ ਰਹੇ ਨਜ਼ਾਰਾ ਵੇ ਮੇਰੇ ਸਿੰਘ ਕਿਵੇਂ ਲੜੀ ਜਾਂਦੇ ਆ ਅਤੇ ਇੱਕ ਦਰਸ਼ਨ ਸਾਹਿਬ ਗੁਰੂਦਵਾਰਾ ਪਠਾਨ ਨੇ ਵਾਰ ਕੀਤਾ ਸੀਗਾ ਗੁਰੂ ਸਾਹਿਬ 'ਤੇ ਜਿਹਨੇ ਤੇ ਉਹ ਵੀ ਉਹਦੀ ਇੱਥੇ ਕਬਰ ਬਣੀ ਉਹਦੀ ਪੱਥਰ ਮਤਲਬ ਕਿ ਛਿੱਤਰ ਮਾਰ ਕੇ ਆਉਂਦੇ ਉਹਦੀ ਕਬਰ 'ਤੇ ਜਿੰਨਾ ਚਿਰ ਉਹ ਦੀ ਕਬਰ 'ਤੇ ਸਾਰੇ ਜਾ ਕੇ ਮਤਲਬ ਕਿ ਦਰਸ਼ਨ ਕਰਕੇ ਉਹਦੀ ਛਿੱਤਰ ਨਹੀਂ ਨਾ ਮਾਰਦੇ ਪੰਜ ਪੰਜ ਉੰਨਾ ਚਿਰ ਉਹ ਜਿਹੜੇ ਯਾਤਰਾ ਸਫਲ ਨਹੀਂ ਹੁੰਦੀ ਹਾਂ ਅਤੇ ਇੱਕ ਫਿਰ ਉੱਥੇ ਗੁਰਦੁਆਰਾ ਟਿੱਬੀ ਸਾਹਿਬ ਆ ਉਹ ਟਿੱਬੀ ਸਾਹਿਬ ਦਰਸ਼ਨ ਸਰ ਸਾਹਿਬ ਰਕਾਬ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਘੋੜੇ ਦੀ ਰਕਾਬ ਟੁੱਟੀ ਸੀਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਗੁਰਦੁਆਰਾ ਇੱਕ ਖੂਹ ਸਰ ਸਾਹਿਬ ਆ ਉੱਥੇ ਵੀ ਹਰ ਸਾਲ ਦਸਮ ਨੌਵੇਂ ਪਾਤਸ਼ਾਹ ਦਾ ਇਤਿਹਾਸ ਮਨਾਇਆ ਜਾਂਦਾ ਆ ਸਮਾਗਮ ਕਰਦੇ ਆ ਦੋ ਤਿੰਨ ਦਿਨ ਦਾ ਹੁੰਦਾ ਇਹ ਚੀਜ਼ਾਂ ਵੇਖਣ ਵਾਲੀਆਂ ਇੱਥੇ ਹੈਗੀਆਂ ਨੇ ਮਤਲਬ ਕੋਈ ਇਸ ਤੋਂ ਬਾਅਦ ਇੱਕ ਅ ਇੱਕ ਪਾਰਕ ਹੋਰ ਆ ਗੁਰੂ ਗੋਬਿੰਦ ਸਿੰਘ ਪਾਰਕ ਬੱਚਿਆਂ ਦੇ ਝੂਲੇ ਝਾਲੇ ਲੱਗੇ ਆ ਤੁਰਨ ਫਿਰਨ ਵਾਸਤੇ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਆ

ਹੋਰ ਬਸ ਜੀ ਤੁਸੀਂ ਹਾਂ ਠੀਕ ਹੈ ਬਸ ਜੀ ਕੋਈ ਨਾ ਤੁਸੀਂ ਆਏ ਆ ਜਾਇਓ ਘਰ ਆ ਜਾਇਓ ਚਾਹ ਪਾਣੀ ਆਪਣਾ ਬਣਾਵਾਂਗੇ ਪੀ ਲਿਓ ਘਰੇ ਘਰ ਗੇੜਾ ਮਾਰ ਲਿਓ ਕੋਈ ਨਹੀਂ ਜਾਣ ਪਹਿਚਾਣ ਹੋ ਜਾਂਦੀ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ